ਮੈਂ ਪਿਛਲੇ ਹਫਤੇ ਹੀ ਐਮਾਜ਼ਾਨ ਐਪ ਤੋਂ ਇੱਕ ਬੂਟਾਂ ਦਾ ਜੋੜਾ ਮੰਗਵਾਇਆ ਸੀ ਜੋ ਕਿ ਮੈਨੂੰ ਬਹੁਤ ਹੀ ਵਧੀਆ ਲੱਗਿਆ ਉਹਦਾ ਰੰਗ ਅਤੇ ਉਹਦਾ ਸਾਈਜ਼ ਵੀ ਬਿਲਕੁਲ ਸਹੀ ਸੀ